ਮੈਂ ਜੋ ਕਿ ਇੱਕ ਕਿਤਾਬ ਪੜ੍ਹੀ ਉਹਨੇ ਮੇਰਾ ਬੋਧਿਕ ਲੈਵਲ ਦਾ ਪੱਧਰ ਬਹੁਤ ਉੱਚਾ ਚੁੱਕਿਆ ਜੋ ਕਿ ਦਲੀਪ ਕੌਰ ਟਿਵਾਣਾ ਜੀ ਦੀ ਇਹੋ ਹਮਾਰਾ ਜੀਵਣਾ ਨਾਵਲ ਆ ਉਹਦੇ ਵਿੱਚ ਉਸ ਸਮੇਂ ਦਾ ਵੀ ਉਹ ਵੀਹਵੀਂ ਸਦੀ 'ਚ ਲਿਖਿਆ ਗਿਆ ਨਾਵਲ ਆ ਵੀ ਉੱਨੀ ਸੌ ਤਿਹੱਤਰ ਤਿਹੱਤਰ 'ਚ ਆ ਉਹਦੇ ਵਿੱਚ ਉਸ ਸਮੇਂ ਦਾ ਜਿਹੜਾ ਔਰਤਾਂ ਦਾ ਪੱਧਰ ਆ ਅਤੇ ਮਰਦਾਂ ਦਾ ਪੱਧਰ ਆ ਵੀ ਉਸ ਸਮੇਂ ਕਿਵੇਂ ਜਗੀਰ ਉਹ ਸੱਭਿਅਤਾ ਸੀ ਅਤੇ ਮਰਦ ਪ੍ਰਧਾਨ ਸਮਾਜ ਸੀ ਜਿਹਦੇ ਵਿੱਚ ਇਹ ਸੀਗੇ ਵੀ ਉਹਦੀ ਇੱਕ ਜਿਹੜੀ ਮੇਨ ਨਾਈਕਾ ਸੀ ਉਹਦਾ ਨਾਮ ਭਾਨੋ ਸੀ ਅਤੇ ਵੀ ਜਿਹੜੀਆਂ ਔਰਤਾਂ ਲਈ ਸਥਿਤੀ ਸੀ ਉਸ ਸਮੇਂ ਵੀ ਔਰਤਾਂ ਨੂੰ ਮਰਦ ਆਪਦੇ ਪੈਰ ਦੀ ਜੁੱਤੀ ਸਮਝਦਾ ਸੀ ਅਤੇ ਉਹਨੂੰ ਜਿੱਥੇ ਚਾਹੇ ਵੇਚ ਸਕਦਾ ਸੀ ਜਿਹਦੇ ਨਾਲ ਚਾਹੇ ਵਿਆਹ ਸਕਦਾ ਸੀ ਅਤੇ ਇੱਕ ਔਰਤ ਨੂੰ ਇੱਕ ਤੋਂ ਵੱਧ ਜਿਵੇਂ ਕਿ ਉਹ ਕਿਸੇ ਇੱਕ ਮਰਦ ਦੀ ਪਤਨੀ ਹੈ ਤਾਂ ਉਹਨੂੰ ਇੱਕ ਤੋਂ ਮਰਦ ਇੱਕ ਤੋਂ ਵੱਧ ਮਰਦ ਵੀ ਆਪਦੇ ਸਰੀਰਕ ਸ਼ੋਸ਼ਣ ਕਰਨ ਲਈ ਉਹਨੂੰ ਵਰਤੋਂ ਕਰਦੇ ਸੀ ਉਹਦੀ ਅਤੇ ਬਹੁਤ ਹੀ ਜ਼ਿਆਦਾ ਦੁਖਾਂਤ ਨਾਵਲ ਆ ਪਰ ਉਹਨੇ ਮੇਰਾ ਬੋਧਿਕ ਪੱਧਰ ਇੰਨਾਂ ਕੁ ਉੱਚਾ ਚੁੱਕਿਆ ਕਿ ਉਸ ਸਮੇਂ ਦੀਆਂ ਸਾਰੀਆਂ ਵੀ ਉਹ ਉਹ ਜਿਹੜੇ ਸਮੇਂ ਵਿੱਚ ਉਹ ਨਾਵਲ ਲਿਖਿਆ ਗਿਆ ਉਸ ਸਮੇਂ ਦਾ ਸਾਰਾ ਸਮਾਜ ਦਾ ਵਰਤਾਵਾ ਪਤਾ ਲੱਗਿਆ ਵਰਤਾਰਾ ਪਤਾ ਲੱਗਿਆ ਵੀ ਉਸ ਸਮੇਂ ਸਮਾਜ ਕਿਵੇਂ ਦਾ ਸੀ ਔਰਤਾਂ ਦੀ ਸਥਿਤੀ ਕੀ ਸੀ ਹਾਲਾਂਕਿ ਉਸ ਕੰਟੈਂਸ ਦੇ ਵਿੱਚ ਅੱਜ ਵੀ ਜੇਕਰ ਅਸੀਂ ਜੋੜ ਕੇ ਦੇਖੀਏ ਤਾਂ ਅੱਜ ਵੀ ਔਰਤ ਨੂੰ ਐਵੇਂ ਦਾ ਹੀ ਸੋਚਿਆ ਜਾਂਦਾ ਕਈ ਕਈ ਜਗ੍ਹਾ ਤੇ' ਅਤੇ ਅੱਜ ਵੀ ਸਾਡੇ ਸਮਾਜ ਵਿੱਚ ਬਾਹਰੋਂ ਜਿਵੇਂ ਕਿ ਆਪਾਂ ਕਹਿ ਦਿੰਦੇ ਬਈਆਂ ਰਾਣੀਆਂ ਯੂਪੀ ਤੋਂ ਲਿਆਈਆਂ ਜਾਂਦੀਆਂ ਸਾਡੇ ਸਮਾਜ ਦੇ ਵਿੱਚ ਅਤੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਗਾਂਹ ਦੀ ਗਾਂਹ ਵੇਚਿਆ ਜਾਂਦਾ ਉਸ ਨਾਵਲ ਨੇ ਮੇਰਾ ਬੌਧਿਕ ਪੱਧਰ ਬਹੁਤ ਉੱਚਾ ਚੁੱਕਿਆ ਸੀ ਅਤੇ ਉਸੇ ਨਾਵਲ 'ਤੇ ਹੀ ਦਲੀਪ ਕੌਰ ਟਿਵਾਣਾ ਜੀ ਨੂੰ ਸਹਿਤ ਅਕੈਡਮੀ ਪੁਰਸਕਾਰ ਮਿਲਿਆ ਸੀ